ਆਪਣੇ ਪਿੰਡ ਵਿੱਚੋਂ ਬਾਹਰ ਯਾਤਰਾ ਕਰਦੇ ਸਮੇਂ ਸਾਨੂੰ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਸਭ ਤੋਂ ਪਹਿਲੀ ਮੁਸ਼ਕਲ ਆਉਂਦੀ ਹੈ ਕਿ ਭੋਜਨ ਦਾ ਕਿੱਥੋਂ ਹੀਲਾ ਕੀਤਾ ਜਾਵੇ ਅਤੇ ਭੋਜਨ ਕਿਸ ਤਰ੍ਹਾਂ ਦਾ ਲਿਆ ਜਾਵੇ ਕਿਉਂਕਿ ਬਾਹਰ ਦਾ ਖਾਣਾ ਸਿਹਤ ਲਈ ਕਈ ਵਾਰ ਹਾਨੀਕਾਰਕ ਵੀ ਹੁੰਦਾ ਹੈ ਅਤੇ ਇਹ ਸਾਡੇ ਬਿਮਾਰ ਹੋਣ ਦਾ ਖਤਰਾ ਵੀ ਬਣ ਸਕਦਾ ਹੈ ਅਤੇ ਇਸ ਤੋਂ ਬਾਅਦ ਸਾਨੂੰ ਕਈ ਪ੍ਰਕਾਰ ਦੀਆਂ ਹੋਰ ਮੁਸ਼ਕਲਾਂ ਵੀ ਆਉਂਦੀਆਂ ਹਨ ਜਿਵੇਂ ਕਿ ਜੇਕਰ ਕੋਈ ਬਿਮਾਰ ਹੋ ਜਾਵੇ ਤਾਂ ਉਸਨੂੰ ਕਿਸ ਡਾਕਟਰ ਕੋਲ ਲਿਆ ਜਾਵੇ ਅਤੇ ਸਮੇਂ 'ਤੇ ਕੀ ਮੁੱਢਲੀ ਸਹਾਇਤਾ ਦਿੱਤੀ ਜਾ ਸਕਦੀ ਹੈ ਕਿਉਂਕਿ ਘਰ ਤਾਂ ਛੇਤੀ ਹੀ ਮੁੱਢਲੀ ਸਹਾਇਤਾ ਦਿੱਤੀ ਜਾ ਸਕਦੀ ਹੈ ਪਰ ਬਾਹਰ ਇੰਨੀ ਛੇਤੀ ਮੁੱਢਲੀ ਸਹਾਇਤਾ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਲੋੜੀਂਦਾ ਸਾਧਨ ਨਹੀਂ ਹੁੰਦੇ ਹਨ